ਮੈਂ ਆਪਣੀ ਲਿਖਤ 'ਤੇ ਫਖਰ ਮਹਿਸੂਸ ਕਰਦਾ ਹਾਂ ਕਿਉਂਕਿ ਮੇਰੀ ਲਿਖਤ ਹੋਰਾਂ ਲੇਖਕਾਂ ਤੋਂ ਵੱਖਰੀ ਹੈ ਕਿਉਂਕਿ ਇਸ ਦੇ ਵਿੱਚ ਸੱਭਿਆਚਾਰਕ ਜਾਂ ਫਿਰ ਗੈਰ ਗਲਪ ਉਹ ਮੌਜ਼ੂਦ ਹੁੰਦਾ ਹੈ ਸੱਭਿਆਚਾਰਕ ਦਾ ਜਿਹੜਾ ਸੱਭਿਆਚਾਰ ਦੇ ਕਲਚਰ ਦੇ ਮੁਤਾਬਕ ਅਤੇ ਜਿਹੜਾ ਮੌਜ਼ੂਦਗੀ ਦੇ ਵਿੱਚ ਲਿਖਿਆ ਜਾਵੇ ਉਹ ਸਭ ਤੋਂ ਅੱਛਾ ਹੋ ਸਕਦਾ ਹੈ ਦੂਸਰੇ ਲੇਖਕ ਕੀ ਕਰਦੇ ਹਨ ਉਹ ਲੱਚਰਤਾ ਅਤੇ ਵੈਸਟਰਨ ਕਲਚਰ ਨੂੰ ਬਹੁਤ ਜ਼ਿਆਦਾ ਪ੍ਰਫੂਲਿਤ ਕਰਦੇ ਨੇ ਬਹੁਤ ਜ਼ਿਆਦਾ ਅੱਗੇ ਵਧਾਉਂਦੇ ਨੇ ਗੈਂਗਵਾਦ ਨਾਲ ਨਿਊ ਜਨਰੇਸ਼ਨ 'ਤੇ ਬਹੁਤ ਜ਼ਿਆਦਾ ਆਪਣਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਮੈਂ ਆਪਣੀ ਜਿਹੜੀ ਲਿਖਤ ਨੂੰ ਸੁਧਾਰਨ ਦੇ ਲਈ ਸਿਰਫ਼ ਇਹੀ ਕੋਸ਼ਿਸ਼ ਕਰਾਂਗਾ ਕਿ ਮੈਂ ਵੱਧ ਤੋਂ ਵੱਧ ਸੱਭਿਆਚਾਰ ਦੇ ਮਤਾਬਕ ਲਿਖਾਂ ਅਤੇ ਮੌਜ਼ੂਦਗੀ ਦੇ ਵਿੱਚ ਜੋ ਚੱਲ ਰਿਹਾ ਅੱਜ ਕੱਲ੍ਹ ਉਸਦੇ ਵਿਰੁੱਧ ਲਿਖਾਂ